ਸਵੀਗੀ ਡਿਲੀਵਰੀ ਪਾਟਨਰ ਗੱਲ ਕਰਦੇ ਪਏ ਹੋ ਹਾਂਜੀ ਤੁਸੀਂ ਮੈਨੂੰ ਇੱਕ ਆਰਡਰ ਦੇ ਦੇ ਕੇ ਗਏ ਹੋ ਹੁਣੇ ਅਤੇ ਉਹ ਆਰਡਰ ਤੁਸੀਂ ਗਲਤ ਦੇ ਗਏ ਹੋ ਮੈਨੂੰ ਮੈਂ ਤੇ ਇੱਕ ਕੜਾਹੀ ਪਨੀਰ ਕੀਤਾ ਸੀਗਾ ਆਰਡਰ ਨਾਲ ਬਟਰ ਨਾਨ ਸੀਗੇ ਐਂਡ ਰਾਇਤਾ ਸੀਗਾ ਐਂਡ ਕੋ ਦੋ ਲੱਛਾ ਪਰਾਂਠੇ ਸੀਗੇ ਨਾਲ ਅਤੇ ਤੁਸੀਂ ਮੈਨੂੰ ਨਿਊਡਲ ਦੇ ਕੇ ਉਹਦੀ ਜਗ੍ਹਾ 'ਤੇ ਅਤੇ ਉਹਦੇ ਲਈ ਹੁਣ ਮੈਨੂੰ ਰਿਟਰਨ ਕਰ ਲਈ ਉਹਨੂੰ ਕੀ ਕਰਨਾ ਪਵੇਗਾ ਹੈਲਪ ਸੈਕਸ਼ਨ 'ਤੇ ਜਾਣਾ ਪਵੇਗਾ ਅਤੇ ਹੈਲਪ ਸੈਕਸ਼ਨ ਤੋਂ ਬਾਅਦ ਕੀ ਕਰਨਾ ਪਵੇਗਾ ਉੱਥੇ ਮੈਨੂੰ

ਅੱਛਾ ਡਿ ਡਿਲੀਵਰੀ ਪਾਰਟਨਰ ਇੱਕ ਹੋਰ ਇਹ ਮੈਨੂੰ ਅਸਾਈਨ ਹੋਵੇਗਾ ਉਹਨਾਂ ਵੱਲੋਂ ਉਹ ਆਪਣੇ ਆਪ ਹੋਵੇਗਾ ਕਿ ਕਿੱਦਾਂ ਮੈਨੂੰ ਗੱਲ ਕਰਨੀ ਪਵੇਗੀ ਕਿਤੇ ਅੱਛਾ ਪਹਿਲਾਂ ਮੈਨੂੰ ਏਜੇਂਟ ਅਸਾਈਨ ਹੋਵੇਗਾ ਸਵਿਗੀ ਐਪ 'ਤੇ ਅਤੇ ਉਸ ਤੋਂ ਬਾਅਦ ਮੈਨੂੰ ਉਹ ਨਵਾਂ ਡਿਲੀਵਰ ਏਜੰਟ ਏਜੰਟ ਅਸਾਈਨ ਕਰਨਗੇ ਠੀਕ ਹੈ ਅਤੇ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਦਿਓਗੇ ਕਿ ਕਿੱਦਾਂ ਆਪਾਂ ਉੱਥੋਂ ਗੱਲ ਕਰਨੀ ਏਜੇਂਟ ਨਾਲ ਹਾਂ ਠੀਕ ਹੈ ਮੇਰੇ ਕੋਲ ਹੈਗਾ ਇੱਥੇ ਹੋਰ ਸੇਵਾਵਾਂ ਦੀ ਹੈਗੀ ਆਪਸ਼ਨ ਅੱਛਾ ਹਾਂ ਇਹ ਤਾਂ ਹੈ ਕਿ ਗਲਤ ਆਡਰ ਆਇਆ ਤੁਹਾਡਾ ਇਹਨੂੰ ਕਲਿੱਕ ਕਰਾਂ ਠੀਕ ਆ ਹਾਂ ਹੋ ਗਿਆ ਮੈਨੂੰ ਏਜੰਟ ਅਸਾਈਨ ਹੋ ਗਿਆ ਇਹਨਾਂ ਨੂੰ ਕੀ ਕਹਾਂ ਕਿ ਗਲਤ ਆਡਰ ਹੋ ਗਿਆ ਵਾ ਅਤੇ ਗਲਤ ਹੀਗੇ ਆਡਰ ਚਲੋ ਠੀਕ ਹੈ ਵੀਰ ਜੀ ਮੈਂ ਕਰ ਲੈਂਦਾ ਗੱਲ ਇਹਨਾਂ ਨਾਲ ਓਕੇ